ਫਤਿਹਗੜ੍ਹ ਸਾਹਿਬ ਵਿੱਚ ਇੱਕ ਯੂਨੀਵਰਸਿਟੀ ਅਤੇ ਦੋ ਕੋਲੇਜ ਹਨ ਸੋ ਇਹਨਾਂ ਕੋਲਜਾਂ ਦੇ ਵਿੱਚ ਅਤੇ ਯੂਨੀਵਰਸਿਟੀਆਂ ਦੇ ਵਿੱਚ ਜੋ ਬਹੁਤ ਸਾਰੇ ਲੋਕ ਇੱਥੇ ਕੰਮ ਕਰਦੇ ਹਨ ਉਹ ਬਹੁਤ ਦੂਰੋਂ ਦੂਰੋਂ ਆਉਂਦੇ ਹਨ ਜਿਵੇਂ ਕਿ ਕਈ ਲੋਕ ਚੰਡੀਗੜ੍ਹ ਮੋਹਾਲੀ ਤੋਂ ਆਉਂਦੇ ਹਨ ਕਈ ਲੋਕ ਲੁਧਿਆਣਾ ਰੋਪੜ ਸਾਈਡ ਤੋਂ ਆਉਂਦੇ ਹਨ ਕਈ ਪਟਿਆਲੇ ਤੋਂ ਆਉਂਦੇ ਹਨ ਅਤੇ ਕਈ ਤਾਂ ਇੱਥੋਂ ਦੂਰੋਂ ਦੂਰੋਂ ਜਿਵੇਂ ਕਿ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਜਾਂ ਫਿਰ ਪੰਜਾਬ ਦੇ ਦੂਰ ਦੂਰ ਜਿਵੇਂ ਕਿ ਬਠਿੰਡਾ ਸਾਈਡ ਤੋਂ ਵੀ ਕਈ ਲੋਕ ਇੱਥੇ ਆ ਕੇ ਨੌਕਰੀ ਕਰ ਰਹੇ ਹਨ ਇਹਨਾਂ ਕੋਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਇਹ ਬਹੁਤ ਚਿਰ ਤੋਂ ਕੰਮ ਕਰ ਰਹੇ ਹਨ ਅਤੇ ਉਹ ਇੱਥੇ ਹੀ ਵਸ ਗਏ ਹਨ ਇੱਥੇ ਹੀ ਉਹਨਾਂ ਨੇ ਘਰ ਬਣਾ ਲਏ ਹਨ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਦੂਰੋਂ ਦੂਰੋਂ ਆ ਕੇ ਵਸੇ ਹਨ ਅਤੇ ਉਹਨਾਂ ਦੀਆਂ ਜਾਤਾ ਜਾਂ ਧਰਮ ਦੇ ਆਧਾਰ 'ਤੇ ਅਸੀਂ ਕਹੀਏ ਤਾਂ ਇੱਥੇ ਬਹੁਤ ਸਾਰੇ ਲੋਕ ਰਹਿੰਦੇ ਹਨ ਜਿਵੇਂ ਕਿ ਕ੍ਰਿਸਚਨ ਵੀ ਰਹਿੰਦੇ ਹਨ ਇੱਥੇ ਕ੍ਰਿਸਚਨ ਸਕੂਲ ਹੈ ਜੀਜਸ ਜੇਵੀਅਰ ਸਕੂਲ ਇੱਥੇ ਜੈਨ ਮੰਦਰ ਵੀ ਹੈ ਜੈਨੀ ਵੀ ਰਹਿੰਦੇ ਹਨ ਇੱਥੇ ਇੱਕ ਮਸਜਿਦ ਵੀ ਹੈ ਇਸ ਲਈ ਮੁਸਲਮਾਨ ਵੀ ਰਹਿੰਦੇ ਹਨ ਅਤੇ ਹਿੰਦੂ ਅਤੇ ਸਿੱਖ ਧਰਮ ਦੇ ਲੋਕ ਵੀ ਰਹਿੰਦੇ ਹਨ ਸਾਰੇ ਧਰਮਾਂ ਦੇ ਲੋਕ ਹੀ ਇੱਥੇ ਰਹਿੰਦੇ ਹਨ ਇੱਕ ਸਾਈਡ ਦੇ ਉੱਤੇ ਰੇਲਵੇ ਸਟੇਸ਼ਨ ਦੇ ਕੋਲ ਤਾਂ ਘੁਮਿਆਰਾਂ ਦੀ ਬਸਤੀ ਹੈ ਜਿੱਥੇ ਬਹੁਤ ਸਾਰੇ ਘੁਮਿਆਰ ਰਹਿੰਦੇ ਹਨ ਉੱਥੇ ਹੀ ਇੱਕ ਬਾਹਮਣ ਮਾਜਰਾ ਨਾਮ ਦਾ ਕਸਬਾ ਵੀ ਹੈ ਉੱਥੇ ਬਹੁਤ ਸਾਰੇ ਜ਼ਿਆਦਾਤਰ ਬ੍ਰਾਹਮਣ ਲੋਕ ਰਹਿੰਦੇ ਹਨ ਪੁਰਾਣੀ ਸਰਹੰਦ ਸਿਟੀ ਵਾਲੀ ਸਾਈਡ 'ਤੇ ਬਹੁਤ ਹੀ ਪੁਰਾਣੇ ਘਰ ਹਨ ਜਿੱਥੇ ਬਹੁਤ ਸਾਰੇ ਪੁਰਾਣੇ ਜੱਦੀ ਲੋਕ ਵੀ ਰਹਿੰਦੇ ਹਨ ਇਸ ਤਰ੍ਹਾਂ ਹਰੇਕ ਤਰ੍ਹਾਂ ਦੇ ਲੋਕ ਦੂਰੋਂ ਦੂਰੋਂ ਇੱਥੇ ਆ ਕੇ ਵਸੇ ਹੋਏ ਹਨ ਉਹ ਆਪਣੇ ਨਾਲ ਆਪਣੀਆਂ ਭਾਸ਼ਾਵਾਂ ਅਤੇ ਆਪਣਾ ਸੱਭਿਆਚਾਰ ਪੰਜਾਬ ਦੇ ਦੂਰ ਦੂਰ ਤੋਂ ਲੈ ਕੇ ਇੱਥੇ ਆਏ ਹਨ ਇਸ ਤਰ੍ਹਾਂ ਇੱਥੇ ਬਹੁਤ ਸਾਰੇ ਲੋਕ ਆਪਣੀ ਆਪਣੀ ਭਾਸ਼ਾ ਵੀ ਨਾਲ ਲੈ ਕੇ ਆਉਂਦੇ ਹਨ ਭਾਵੇਂ ਬੋਲਦੇ ਬਹੁਤ ਸਾਰੇ ਲੋਕ ਪੰਜਾਬੀ ਹੀ ਹਨ ਪਰ ਹਰੇਕ ਦਾ ਬੋਲਣ ਦਾ ਲਹਿਜਾ ਜਾਂ ਐਕਸੈਂਟ ਅਲੱਗ ਅਲੱਗ ਹੁੰਦਾ ਹੈ